ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਮੈਂ ਸੁਰਜੀਤ ਸਿੰਘ ਗੱਲ ਕਰ ਰਿਹਾ ਅਤੇ ਮੈਂ ਇਹ ਜਾਣਕਾਰੀ ਲੈਣੀ ਸੀ ਕਿ ਅਗਰ ਮੈਂ ਰਾਤ ਨੂੰ ਬਾਈ ਚਾਂਸ ਤੁਹਾਡੇ ਏਰੀਏ ਦੇ ਵਿੱਚ ਡੇਲੀ ਟਰੈਵਲ ਕਰ ਰਿਹਾ ਹੁਣ ਮੈਂ ਬਾਈ ਚਾਂਸ ਕਦੇ ਦਸ ਵਜੇ ਆਵਾਂ ਕਈ ਵਾਰ ਮੈਂ ਬਾਰਾਂ ਵਜੇ ਆਵਾਂ ਕਈ ਵਾਰ ਮੈਂ ਦੋ ਤਿੰਨ ਵਜੇ ਵੀ ਆ ਸਕਦਾ ਤੁਹਾਡੇ ਏਰੀਏ ਦੇ ਵਿੱਚ ਅਗਰ ਮੈਨੂੰ ਖਾਣ ਪੀਣ ਦਾ ਸਮਾਨ ਤੁਹਾਡੇ ਹੋਟਲ ਤੋਂ ਮਿਲ ਸਕਦਾ ਉਪਲਬਧ ਹੋ ਸਕਦਾ ਇੱਦਾਂ ਹੈ ਨਾ ਕਿ ਆਪਾਂ ਕਦੇ ਵੀ ਰਾਤ ਨੂੰ ਫੋਨ ਕਰੀਏ ਆਪਾਂ ਨੂੰ ਲੋੜ ਪਵੇ ਆਪਾਂ ਉਸ ਹਿਸਾਬ ਦੇ ਨਾਲ ਤੁਹਾਨੂੰ ਫੋਨ ਕਰ ਲਿਆ ਕਰਾਂਗੇ ਤੁਹਾਤੋਂ ਸਮਾਨ ਔਡਰ ਕਰ ਲ ਕਰ ਲਿਆ ਕਰਾਂਗੇ ਅਤੇ ਬਾਕੀ ਖਾਣ ਪੀਣ ਦਾ ਸਰ ਉਹ ਕਿਆ ਖਾਣਾ ਹੁੰਦਾ ਬੰਦੇ ਨੇ ਦੋ ਰੋਟੀ ਹੁੰਦੀ ਹੈ ਥੋੜ੍ਹੇ ਬਹੁਤੇ ਚਾਵਲ ਹੋ ਗਏ ਕੋਈ ਦਾਲ ਸਬਜ਼ੀ ਹੋ ਗਈ ਚਲੋ ਠੀਕ ਹੈ ਸਰ ਕੋਈ ਗੱਲ ਨਹੀਂ ਹੈ ਜੀ ਮੈਂ ਜਦ ਵੀ ਆਉਂਗਾ ਸਮਾਨ ਤੁਹਾਤੋਂ ਇਧਰਲੀ ਸਾਈਡ ਤੋਂ ਔਰਡਰ ਕਰ ਲਿਆ ਕਰੂੰਗਾ ਠੀਕ ਹੈ ਸਰ ਥੈਂਕ ਯੂ ਸੋ ਮਚ ਜੀ